ਭਾਰ ਵਧਾਉਣ ਲਈ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਸੇ ਵਿਅਕਤੀ ਲਈ ਤੁਹਾਡੇ ਪਿੰਡ ਵਿੱਚ ਘਰੇਲੂ ਅਤੇ ਉਪਚਾਰ ਕੀ ਹਨ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਸੇ ਵਿਅਕਤੀ ਲਈ ਸਾਡੇ ਪਿੰਡ ਵਿੱਚ ਕਈ ਪ੍ਰਸਿੱਧ ਘਰੇਲੂ ਉਪਚਾਰ ਹਨ ਸਭ ਤੋਂ ਪਹਿਲਾਂ ਉਹ ਲੋਕ ਕਥਰਸ ਦੇਸੀ ਘਿਓ ਅਤੇ ਮੱਖਣ ਦੀ ਵਰਤੋਂ ਕਰਦੇ ਹਨ ਜੋ ਕੋਈ ਰੋਕਰ ਅਤੇ ਚਰਬੀ ਨਾਲ ਭਰਪੂਰ ਹੁੰਦੇ ਹਨ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦਕ ਵੀ ਭਾਰ ਵਧਾਉਂਦੇ ਹਨ ਬਹੁਤ ਫਾਈਦੇਮਨ ਹਨ ਫਾਇਦੇਮੰਦ ਹਨ ਇਸ ਤੋਂ ਇਲਾਵਾ ਲੋਕ ਕੇਲੇ ਅਤੇ ਅੰਬ ਵਾਂਗ ਫਲ ਨੂੰ ਵੀ ਖਾਂਦੇ ਹਨ ਅਤੇ ਸਹੀ ਹਨ ਕਿਉਂਕਿ ਉਹ ਊਰਜਾ ਲਈ ਭਰਪੂਰ ਹੁੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਖਣਿਜ ਜਾਂ ਅਮੀਰੀ ਪਾ ਕੇ ਪੀਂਦੇ ਹਨ ਇੱਕ ਆਮ ਉਪਚਾਰ ਹੈ ਇਸ ਤੋਂ ਇਲਾਵਾ ਲੋਕ ਸ਼ਰਬਤ ਅਨਾਜ ਅਤੇ ਦਾਲ ਨੂੰ ਆਪਣੇ ਖੁਰਾਕ ਵਿੱਚ ਸ਼ਾਮਿਲ ਕਰਦੇ ਹਨ ਸਹੀ ਤਰਾਂ ਕਿਉਂਕਿ ਪ੍ਰੋਟੀਨ ਅਤੇ ਕਾਰਬਨਹਾਈਡ੍ਰੇਟ ਨਾਲ ਭਰਪੂਰ ਹਨ ਅਤੇ ਆਮ ਤੌਰ 'ਤੇ ਸਾਡੇ ਪਿੰਡਾਂ ਵਿੱਚ ਲੋਕ ਕੁਦਰਤ ਅਤੇ ਪੋਸ਼ਟਿਕ ਭੋਜਨ ਨੇ ਤਾਂ ਯਾਦ ਦਿੰਦਿਆਂ ਅਤੇ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਂਦੇ ਹਨ ਧੰਨਵਾਦ